ਸਾਡੀ ਰਸੋਈ ਦੇ ਵਿੱਚ ਬਿਜਲੀ ਦੇ ਜਿਹੜੇ ਉਪਕਰਨ ਆ ਨਾ ਉਹ ਜਿੱਦਾਂ ਮਤਲਬ ਹੀਟਰ ਵੀ ਆ ਮਿਕਸਚਰ ਵੀ ਆ ਗਰਾਈਂਡਰ ਵੀ ਆ ਓਵਨ ਵੀ ਆ ਅਤੇ ਬਾਕੀ ਜਿਹੜਾ ਨਾ ਮਤਲਬ ਗੈਸ ਸਿਲੰਡਰ ਵੀ ਚਲੋ ਹੁਣ ਤਾਂ ਚੱਲ ਪਏ ਹੈ ਲੇਕਿਨ ਜਿਹੜੇ ਪਹਿਲਾਂ ਆਪਣੇ ਲੱਕੜ ਦਾ ਗੋਹਿਆਂ ਦਾ ਕੰਮ ਚੱਲਦਾ ਸੀ ਰਸੋਈ ਦੇ ਵਿੱਚ ਉਹਦੇ ਨਾਲ਼ ਰੋਟੀ ਬਣਦੀ ਸੀ ਅਤੇ ਪਹਿਲਾਂ ਇਹ ਉਪਲਬਧ ਨਹੀਂ ਸੀਗੀਆਂ ਚੀਜ਼ਾਂ ਅਤੇ ਇਸ ਕਰਕੇ ਹੁਣ ਕਾਫ਼ੀ ਅੱਛੇ ਉਪਕਰਨ ਆ ਗਏ ਆ ਧੰਨਵਾਦ